ਖਾਣਾ ਬਣਾਉਣ ਦੇ ਸ਼ੌਕ ਨੂੰ ਅਪਣਾਉਣ ਵਿੱਚ ਮੇਰੀ ਮਾਂ ਦੀ ਬਹੁਤ ਵੱਡੀ ਭੂਮਿਕਾ ਹੈ ਉਹਨਾਂ ਵੱਲੋਂ ਹੀ ਮੈਨੂੰ ਖਾਣਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੇ ਦਿਲ ਵਿੱਚ ਜਾਣ ਦਾ ਰਸਤਾ ਪੇਟ ਹੁੰਦਾ ਹੈ ਇਸ ਲਈ ਖਾਣਾ ਬਣਾਉਣਾ ਇੱਕ ਕਲਾ ਹੈ ਅਤੇ ਪਿਆਰ ਨਾਲ਼ ਬਣਾਉਣਾ ਚਾਹੀਦਾ ਹੈ ਅਤੇ ਸਾਨੂੰ ਸਾਰੇ ਖਾਣਾ ਬਣਾਉਣ ਵਾਲੀ ਸਮੱਗਰੀਆਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਮੈਂ ਖਾਣਾ ਬਣਾਉਣ ਵਿੱਚ ਮਾਹਿਰਤਾ ਹਾਸਿਲ ਕੀਤੀ ਹੈ ਜਿਸ ਵਿੱਚ ਕਿ ਮੇਰੀ ਮਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ